ਮੇਰੀ ਮਨਪਸੰਦ ਕਿਤਾਬ ਹੈ ਸੋਹਣ ਸਿੰਘ ਸੀਤਲ ਦੀ ਗੁਰੂ ਗੋਬਿੰਦ ਸਿੰਘ ਜੀ 'ਤੇ ਜੀਵਨੀ 'ਤੇ ਜਿਵੇਂ ਸਭ ਨੂੰ ਪਤਾ ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ ਦਸਵੇਂ ਗੁਰੂ ਹੋਏ ਹਨ ਗੁਰੂ ਗੋਬਿੰਦ ਸਿੰਘ ਜੀ ਬਾਰੇ ਸਾਰੀ ਦੁਨੀਆਂ ਜਾਣਦੀ ਹੈ ਉਹਨਾਂ ਨੇ ਕਿੰਨੀ ਸ਼ਹੀਦੀਆਂ ਦਿੱਤੀਆਂ ਆਪਣੇ ਵ ਵੰਸ ਵਾਰਤਾ ਤਾਂ ਜੋ ਅਸੀਂ ਸੁਖੀ ਰਹਿ ਸਕਣ ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ ਦਸਵੇਂ ਗੁਰੂ ਹੋਏ ਹਨ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ ਸਨ ਦੋ ਸਰੇ ਜੋ ਦੋ ਸਾਹਿਬਜ਼ਾਦੇ ਫਤਿਹਗੜ੍ਹ ਸਾਹਿਬ ਸ਼ਹੀਦ ਹੋਏ ਜੋ ਕਿ ਮੁਗਲਾਂ ਨੇ ਜ਼ਾਲਮ ਨ ਜ਼ਾਲਮਾਂ ਨੇ ਨੀਹਾਂ ਵਿੱਚ ਚਿਣਵਾ ਦਿੱਤੇ ਅਤੇ ਦੋ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਜੰਗ ਵਿੱਚ ਲੜਦੇ ਹੋਏ ਮੁਗਲਾਂ ਦਾ ਸਾਹਮਣਾ ਕਰਦੇ ਹੋਏ ਸ਼ਹੀਦ ਹੋਏ ਗੁਰੂ ਗੋਬਿੰਦ ਸਿੰਘ ਜੀ ਨੇ ਹਮੇਸ਼ਾਂ ਜ਼ੁਲਮ ਦਾ ਨਾਸ਼ ਕੀਤਾ

ਤੇਗ ਅਤੇ ਦੇ ਦੇਗ ਅਤੇ ਤੇਗ ਦੋਨੋਂ ਦਾ ਵਰਤੋਂ ਕਰਨ ਨੂੰ ਕਿਹਾ ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ ਦਸਵੇਂ ਗੁਰੂ ਰਹੇ ਹਨ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ 'ਤੇ ਚਾਰ ਸਾਹਿਬਜ਼ਾਦੇ ਫਿਲਮ ਵੀ ਆਈ ਹੈ ਜੋ ਕਿ ਬੱਚਿਆਂ ਲਈ ਬਹੁਤ ਵੱਡੀ ਸਿੱਖਿਆ ਹਨ ਜਿਸ ਵਿੱਚ ਸਾਰਾ ਉਹਨਾਂ ਦਾ ਜੀਵਨ ਅਤੇ ਕਿਵੇਂ ਛੋਟੇ ਵੱਡੇ ਸਾਹਿਬਜ਼ਾਦਿਆਂ ਨੇ ਸ਼ਹੀਦੀਆਂ ਪਾਈਆਂ ਉਹ ਸਭ ਕੁਝ ਦਰਸਾਇਆ ਹੋਇਆ ਹੈ ਬਹੁਤ ਵਧੀਆ ਬੱਚਿਆਂ ਨੂੰ ਪ੍ਰਭਾਵਿਤ ਕਰਨ ਵਾਲੀ ਫਿਲਮ ਹੈ ਅਤੇ ਇਹ ਬੱਚਿਆਂ ਨੂੰ ਜ਼ਰੂਰ ਦਿਖਾਉਣੀ ਚਾਹੀਦੀ ਹੈ ਗੁਰੂ ਗੋਬਿੰਦ ਸਿੰਘ ਜੀ ਅਤੇ ਗੁਰੂ ਰਾਮਦਾਸ ਜੀ ਦਾ ਇੱਕ ਵਾਰਤਾਲਾਪ ਹੈ ਇੱਕ ਵਿਅਕਤੀ ਗੁਰੂ ਗੁਰੂ ਰਾਮਦਾਸ ਜੀ ਦੇ ਦਰਬਾਰ 'ਤੇ ਆਉਂਦਾ ਹੈ ਅਤੇ ਉਹ ਹਲਕਾ ਹੋਇਆ ਮੁਸਕੁਰਾਉਂਦਾ ਹੋਇਆ ਕਹਿੰਦਾ ਹੈ ਗੁਰੂ ਰਾਮਦਾਸ ਜੀ ਤੁਸੀਂ ਸਾਡੇ ਘਰ ਆਇਓ ਸਾਨੂੰ ਦਰਸ਼ਨ ਦਿਓ ਗੁਰੂ ਰਾਮਦਾਸ ਜੀ ਨੇ ਹੱਸਦੇ ਹੋਏ ਕਿਹਾ ਕਿ ਅਸੀਂ ਤੁਹਾਡੇ ਕੋਲ ਨੌਵੇਂ ਜਾਮੇ ਵਿੱਚ ਆਵਾਂਗੇ ਜਦੋਂ ਤੁਹਾਡੇ 'ਤੇ ਗਰੀਬੀ ਘੱਟ ਹੋਵੇਗੀ ਅਤੇ ਅਮੀਰੀ ਹੋਵੇਗੀ ਗੁਰੂ ਗੋਬਿੰਦ ਸਿੰਘ ਜੀ ਇੱਕ ਦੁਨੀਆਂ ਲਈ ਮਿਸਾਲ ਹਨ ਕਿ ਕਿਵੇਂ ਜ਼ੁਲਮ ਦਾ ਨਾਸ਼ ਕਰਨਾ ਕਰਨ ਲਈ ਤਲਵਾਰ ਚੁੱਕਣੀ ਪੈਂਦੀ ਹੈ